ਹੈਲੋ ਸਤਿ ਸ਼੍ਰੀ ਅਕਾਲ ਜੀ ਐਮ ਐਲ ਏ ਮੰਗਲ ਸਿੰਘ ਬੋਲ ਰਹੇ ਜੀ ਸਰ ਮੈਂ ਕਰਮਾ ਸਿੰਘ ਬੋਲ ਰਿਹਾ ਬਰਨਾਲੇ ਤੋਂ ਅਤੇ ਮੈਂ ਨਾ ਜੀ ਤੁਹਾਡੇ ਤੁਹਾਡੇ ਕੰਮ ਤੋਂ ਬਹੁਤ ਪ੍ਰਭਾਵਿਤ ਹੋਇਆ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਸ਼ਹਿਰਾਂ 'ਚ ਪਿੰਡਾਂ 'ਚ ਜਾ ਜਾ ਕੇ ਤਾਂ ਇੱਕ ਬੇਨਤੀ ਹੈ ਜੀ ਮੇਰੀ ਵੀ ਕਿ ਬਰਨਾਲਾ ਸ਼ਹਿਰ ਵਿੱਚ ਜਾਣਾ ਜੀ ਸਾਡੇ ਮੁਹੱਲੇ ਵਿੱਚ ਹੈ ਨਾ ਸੜਕਾਂ ਕੱਚੀਆਂ ਨੇ ਟੁੱਟੀਆਂ ਹੋਈਆਂ ਨੇ ਹੈ ਨਾ ਅਤੇ ਜਿਨ੍ਹਾਂ ਕਰਕੇ ਆਉਣਾ ਜਾਣਾ ਔਖਾ ਹੋ ਰਿਹਾ ਤਾਂ ਕਈ ਵਾਰ ਐਕਸੀਡੈਂਟ ਦਾ ਵੀ ਕਾਰਨ ਬਣ ਜਾਂਦੀਆਂ ਨੇ ਸੜਕਾਂ ਇੱਕ ਲਾਈਟ ਨਹੀਂ ਹੈਗੀ ਜੀ ਰਾਤ ਨੂੰ ਲੰਘਣਾ ਕਰਨਾ ਔਖਾ ਹੋ ਜਾਂਦਾ ਅਤੇ ਸੀਵਰੇਜ ਦਾ ਕੋਈ ਖਾਸ ਪ੍ਰਬੰਧ ਨਹੀਂ ਹੈਗਾ ਅਤੇ ਨਾ ਹੀ ਇੱਥੇ ਬੱਚਿਆਂ ਲਈ ਖੇਡ ਲਈ ਸਪੋਰਟਸ ਗਰਾਊਂਡ ਹੈ ਅਤੇ ਉਹਨਾਂ ਨੂੰ ਬਾਹਰ ਜਾ ਕੇ ਖੇਡਣਾ ਪਿਆ ਤਾਂ ਤਾਂ ਜੋ ਉਹਨਾਂ ਨੂੰ ਬਹੁਤ ਦਿੱਕਤ ਆ ਰਹੀ ਹੈ ਅਤੇ ਤੁਸੀਂ ਅਤੇ ਤੁਸੀਂ ਮੇਰੀ ਇਹ 'ਚ ਸਹਾਇਤਾ ਕਰੋ ਸਰ ਤਾਂ ਕਿ ਹੈ ਨਾ ਮੈਂ ਆਪਣੇ ਮੁਹੱਲੇ ਨੂੰ ਵਧੀਆ ਕਾਮਯਾਬ ਬਣਾ ਸਕਾਂ ਅਤੇ ਸਾਫ ਸੁਥਰਾ ਬਣਾ ਸਕਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਤੁਹਾਡੇ ਨਾਲ ਹੀ ਹੈ ਸਰ ਅਸੀਂ ਬਰਨਾਲਾ ਤੋਂ ਆ ਸਰ ਰਾਮ ਨਗਰ 'ਚ ਜੀ ਠੀਕ ਹੈ ਤੁਹਾਡਾ ਬਹੁਤ ਧੰਨਵਾਦ ਜੀ ਠੀਕ ਹੈ ਧੰਨਵਾਦ ਜੀ ਤੁਹਾਡਾ ਠੀਕ